ਆਮ ਤੌਰ 'ਤੇ ਵੇਖਿਆ ਜਾਵੇ ਤਾਂ ਮੇਰੇ ਘਰ ਵਿੱਚ ਚੌਵੀ ਘੰਟੇ ਬਿਜਲੀ ਆਉਂਦੀ ਹੈ ਦਿਨ ਵਿੱਚ ਬਹੁਤੇ ਹੀ ਕੱਟ ਇੱਦਾਂ ਦੇ ਸਮੇਂ ਹੁੰਦੇ ਹਨ ਜਿਨ੍ਹਾਂ ਵਿੱਚ ਬਿਜਲੀ ਦਾ ਕੱਟ ਲੱਗਦਾ ਹੈ ਲੇਕਿਨ ਜਦੋਂ ਕੱਟ ਲੱਗਦਾ ਹੈ ਤਾਂ ਬਹੁਤ ਪਰੇਸ਼ਾਨੀ ਹੁੰਦੀ ਹੈ ਕੱਟ ਇਸ ਕਰਕੇ ਲੱਗਦੇ ਹਨ ਕਿ ਬਿਜਲੀ ਦੀ ਲਾਈਨ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਕਮੀ ਪੈ ਜਾਂਦੀ ਹੈ ਜਿਸ ਕਾਰਨ ਬਿਜਲੀ ਕੱਟ ਦਿੱਤੀ ਜਾਂਦੀ ਹੈ ਵੱਖ ਵੱਖ ਮੌਸਮਾਂ ਦੌਰਾਨ ਬਿਜਲੀ ਦੇ ਕੱਟ ਕਾਰਨ ਸਾਡੀ ਜ਼ਿੰਦਗੀ ਬਹੁਤ ਪ੍ਰਭਾਵਿਤ ਹੁੰਦੀ ਹੈ ਜੇਕਰ ਗੱਲ ਗਰਮੀ ਦੀ ਕੀਤੀ ਜਾਵੇ ਤਾਂ ਪੰਜਾਬ ਵਿੱਚ ਗਰਮੀ ਬਹੁਤ ਹੀ ਅੱਤ ਦੀ ਪੈਂਦੀ ਹੈ ਜਿਸ ਕਰਕੇ ਲੋਕਾਂ ਦਾ ਜੀਣਾ ਰਹਿਣਾ ਮੁਸ਼ਕਲ ਹੋ ਜਾਂਦਾ ਹੈ ਪੰਜਾਬ ਵਿੱਚ ਗਰਮੀ ਇੰਨੀ ਜ਼ਿਆਦਾ ਹੋਣ ਕਰਕੇ ਬਿਜਲੀ ਦੇ ਕੱਟ ਦੌਰਾਨ ਲੋਕਾਂ ਨੂੰ ਬਹੁਤ ਹੀ ਪਰੇਸ਼ਾਨੀ ਹੁੰਦੀ ਹੈ ਜੇਕਰ ਗੱਲ ਠੰਡੀਆਂ ਦੀ ਕੀਤੀ ਜਾਵੇ ਤਾਂ ਠੰਡ ਵੀ ਪੰਜਾਬ ਵਿੱਚ ਘੱਟ ਨਹੀਂ ਪੈਂਦੀ ਪੰਜਾਬ ਵਿੱਚ ਠੰਡ ਬਹੁਤ ਅੱਤ ਦੀ ਪੈਂਦੀ ਹੈ ਠੰਡੀਆਂ ਦੌਰਾਨ ਬਿਜਲੀ ਦੇ ਕੱਟ ਲੱਗਣ ਕਾਰਨ ਲੋਕਾਂ ਦੇ ਹੀਟਰ ਵਗੈਰਾ ਚੱਲਣੇ ਬੰਦ ਹੋ ਜਾਂਦੇ ਹਨ ਜਿਨ੍ਹਾਂ ਕਰਕੇ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਗੱਲ ਭਾਵੇਂ ਕਿਸੇ ਵੀ ਮੌਸਮ ਦੀ ਕੀਤੀ ਜਾਵੇ ਬਿਜਲੀ ਦੇ ਕੱਟ ਕਰਕੇ ਲੋਕਾਂ ਨੂੰ ਬਹੁਤ ਹੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਇਹ ਅੱਜ ਕੱਲ੍ਹ ਸਾਡੇ ਜੀਵਨ ਦਾ ਇੱਕ ਹਿੱਸਾ ਬਣਦੀ ਜਾ ਰਹੀ ਹੈ